ਮੈਨੂੰ ਆਪਣੇ ਘਰ ਵਿੱਚ ਆਲੂ ਵਾਲਾ ਪਰੌਂਠਾ ਬਣਾਉਣਾ ਬਹੁਤ ਵਧੀਆ ਲੱਗਦਾ ਹੈ ਮੈਨੂੰ ਉਹਨਾਂ ਵਿੱਚ ਬਹੁਤ ਮਜ਼ਾ ਆਉਂਦਾ ਬਣਾਉਣ ਵਿੱਚ ਆਲੂ ਵਾਲਾ ਪਰੌਂਠਾ ਗੋਭੀ ਵਾਲਾ ਪਰੌਂਠਾ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਆਪਣੇ ਘਰਦਿਆਂ ਨੂੰ ਵਧੀਆ ਨਾਸ਼ਤਾ ਬਣਾ ਕੇ ਖਵਾ ਸਕਾਂ ਤਾਂ ਕਿ ਮੇਰੀ ਫੈਮਲੀ ਮੇਰੇ ਪਰੌਂਠੇ ਨੂੰ ਬਹੁਤ ਪਸੰਦ ਕਰਦੀ ਹੈ ਤਾਂ ਕਿ ਮੇਰੀਆਂ ਸਹੇਲੀਆਂ ਮੈਨੂੰ ਫੋਨ ਕਰਕੇ ਪੁੱਛਦੀਆਂ ਹਨ ਕਿ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਬਹੁਤ ਟੇਸਟੀ ਹੁੰਦੇ ਹੈ ਫਿਰ ਮੈਂ ਉਹਨਾਂ ਨੂੰ ਫੋਨ 'ਤੇ ਦੱਸਦੀ ਹਾਂ ਕਿ ਮੈਂ ਇਸ ਤਰ੍ਹਾਂ ਪਰੌਂਠਾ ਬਣਾਉਂਦੀ ਹਾਂ ਤੁਸੀਂ ਵੀ ਬਣਾ ਕੇ ਦੇਖੋ ਮੇਰੀ ਫੈਮਿਲੀ ਬਹੁਤ ਪਥਾ ਪਸੰਦ ਕਰਦੀ ਹੈ ਤਾਂ ਕਿ ਮੈਂ ਆਪਣੇ ਘਰਦਿਆਂ ਨੂੰ ਵਧੀਆ ਤਰੀਕੇ ਨਾਲ ਪਰੌਂਠਾ ਬਣਾ ਕੇ ਖਵਾ ਸਕਾ ਹੋਰ ਵੀ ਕੁਛ ਬੜਾ ਕੁਛ ਬਣਾਉਣਾ ਮੈਨੂੰ ਬਹੁਤ ਪਸੰਦ ਹੁੰਦਾ ਕਿ ਮੈਂ ਆਪਣੇ ਘਰ ਵਿੱਚ ਦੁਬਾਰਾ ਕੋਈ ਭੋਜਨ ਐਸਾ ਬਣਾਵਾਂ ਕਿ ਸਾਰਿਆਂ ਨੂੰ ਪਸੰਦ ਹੋਵੇ ਫਿਰ ਮੈਂ ਮੇਰੀ ਫੈਮਲੀ ਵੀ ਮੈਨੂੰ ਇਹੀ ਕਹਿੰਦੀ ਹੈ ਕਿ ਤੁਸੀਂ ਬਹੁਤ ਵਧੀਆ ਰੋਟੀ ਬਣਾਉਂਦੇ ਹੋ ਪਰੌਂਠੇ ਵੀ ਵਧੀਆ ਬਣਾਉਂਦੇ ਹੋ ਉਹ ਗੋਭੀ ਵਾਲੇ ਵੀ ਬਹੁਤ ਵਧੀਆ ਹੁੰਦੇ ਹੈ ਪਰੌਂਠਾ ਆਲੂ ਵਾਲੇ ਵੀ ਬਹੁਤ ਵਧੀਆ ਬਣਦੇ ਆ ਫਿਰ ਮੇਰੇ ਘਰ ਦੇ ਬਹੁਤ ਹੀ ਪਸੰਦ ਕਰਦੇ ਆ ਅਸੀਂ ਜਦੋਂ ਵੀ ਸਾਡਾ ਦਿਲ ਕਰਦਾ ਅਸੀਂ ਉਦੋਂ ਹੀ ਬਣਾ ਲੈਂਦੇ ਹਾਂ ਜਦੋਂ ਮੇਰੀ ਫੈਮਲੀ ਕਹਿੰਦੀ ਹੈ ਕਿ ਤੁਹਾਨੂੰ ਖਾਣਾ ਮਤਲਬ ਪਰੌਂਠੇ ਅੱਜ ਮੈਂ ਸਾਡਾ ਦਿਲ ਕਰ ਰਿਹਾ ਅੱਜ ਤੂੰ ਪਰੌਂਠੇ ਬਣਾ ਜਿਸ ਤਰ੍ਹਾਂ ਵੀ ਬਣਾਉਂਦੀ ਹੈ ਬਣਾ ਕੇ ਦੱਸ ਸਾਨੂੰ ਬਣਾ ਕੇ ਖਵਾ ਫਿਰ ਮੈਂ ਆਪਣੀ ਫੈਮਿਲੀ ਨੂੰ ਪਰੌਂਠਾ ਬਣਾ ਕੇ ਖਵਾਉਂਦੀ ਹਾਂ ਅਤੇ ਬਹੁਤ ਪਸੰਦ ਕਰਦੇ ਆ ਮੈਨੂੰ ਬਹੁਤ ਵਧੀਆ ਲੈ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ ਫਿਰ ਮੇਰੀਆਂ ਫ੍ਰੈਂਡਸ ਸਰਕਲ ਵੀ ਆਉਣ ਕੇ ਮੈਂ ਜਿਸ ਨੂੰ ਵੀ ਜਦੋਂ ਵੀ ਸਾਡੇ ਘਰ ਕੋਈ ਗੈਸਟ ਜਾਂ ਮੇਰੀ ਫਰੈਂਡ ਸਰਕਲ ਆਉਣ 'ਤੇ ਮੈਂ ਉਹਨਾਂ ਨੂੰ ਵੀ ਬਣਾ ਕੇ ਖ਼ਵਾਉਂਦੀ ਹਾਂ ਉਹ ਬਹੁਤ ਮੈਨੂੰ ਬਹੁਤ ਕਹਿੰਦੇ ਕਿ ਤੁਹਾਡਾ ਪਰੌਂਠਾ ਬਹੁਤ ਵਧੀਆ ਬਹੁਤ ਟੇਸਟੀ ਹੈ